ਮੈਂ ਕੱਲ੍ਹ ਪਰਸੋਂ ਐਮਾਜ਼ੋਨ ਤੋਂ ਟੈਂਡਮ ਦਾ ਸਟੋਪ ਆਰਡਰ ਕੀਤਾ ਜੋ ਕਿ ਮੈਨੂੰ ਅੱਜ ਸਵੇਰੇ ਰਿਸੀਵ ਹੋਇਆ ਤੋ ਮੈਂ ਉਹਨਾਂ ਬਾਰੇ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਪਾਰਸਲ ਖੋਲਿਆ ਤਾਂ ਉਹ ਅੰਦਰੋਂ ਬ੍ਰੇਕ ਹੋਇਆ ਹੋਇਆ ਸੀ ਜੋ ਸਟੋਪ ਵੀ ਚੰਗੀ ਤਰ੍ਹਾਂ ਕੰਮ ਨਹੀਂ ਸੀ ਕਰ ਰਿਹਾ ਸੋ ਇਟ ਮਾਈ ਮੇਰੀ ਬੇਨਤੀ ਹੈ ਕਿ ਮੇਰਾ ਜਿਹੜਾ ਸਟੋਕ ਜੋ ਮੈਂ ਆਰਡਰ ਕੀਤਾ ਇਸ ਨੂੰ ਰਿਪਲੇ ਰਿਪਲੇਸ ਕਰ ਦਿੱਤਾ ਜਾਵੇ ਨਵੇਂ ਸਟੋਪ ਨਾਲ